ਸਤਿ ਸ਼੍ਰੀ ਅਕਾਲ ਜੀ ਸੱਚੀ ਕਵਾਂ ਤਾਂ ਮੇਰੇ ਕੋਲ ਇੱਕ ਅਸਲੀ ਕੈਮਰਾ ਤਾਂ ਨਹੀਂ ਹੈ ਜੋ ਵੀ ਫੋਟੋਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਸੀਂ ਖਿੱਚਦੇ ਹਾਂ ਉਹ ਮੋਬਾਈਲ ਦੇ ਕੈਮਰੇ ਨਾਲ ਹੀ ਖਿੱਚਦੇ ਹਾਂ ਅਤੇ ਮੋਬਾਈਲ ਦੇ ਕੈਮਰੇ ਦੇ ਨਾਲ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੋ ਰਹੀਆਂ ਘਟਨਾਵਾਂ ਜਿਵੇਂ ਕਿ ਕੋਈ ਵੀ ਸਪੈਸ਼ਲ ਮੋਮੈਂਟ ਹੁੰਦਾ ਕਿਸੇ ਦਾ ਬਰਡੇ ਹੁੰਦਾ ਕੋਈ ਵੀ ਚੀਜ਼ ਸਾਨੂੰ ਲੱਗਦੀ ਹੈ ਕੋਈ ਉਟ ਪਟਾਂਗ ਹਰਕਤ ਕਰਦਾ ਹੋਇਆ ਉਹਨੂੰ ਉਹਦੇ ਨਾਲ ਉਹਦੀਆਂ ਫੋਟੋਆਂ ਖਿੱਚਣ ਦਾ ਮੈਨੂੰ ਬੜਾ ਸ਼ੌਂਕ ਹੈ ਮੈਂ ਆਪਣੀ ਫੋਟੋਆਂ ਘੱਟ ਖਿੱਚਦੀ ਹਾਂ ਲੇਕਿਨ ਹਾਂ ਦੂਜਿਆਂ ਦੀ ਫੋਟੋਆਂ ਖਿੱਚਣ ਦਾ ਸ਼ੌਂਕ ਮੈਨੂੰ ਬਹੁਤ ਜ਼ਿਆਦਾ ਹੈ ਇਸ ਤੋਂ ਇਲਾਵਾ ਕਦੇ ਕਦੇ ਸ਼ਾਮ ਨੂੰ ਮੌਸਮ ਜਾਂ ਸਵੇਰੇ ਬੂਮ ਮੌਸਮ ਬਹੁਤ ਵਧੀਆ ਹੋ ਜਾਂਦਾ ਤਾਂ ਉਹ ਸੂਰਜ ਦੀ ਜਿਹੜੀ ਸੰਨਸੈਟ ਹੁੰਦੇ ਆ ਜਾਂ ਸਨਰਾਈਜ਼ ਆਪਾਂ ਕਹਿ ਦਿੰਦੇ ਹਾਂ ਉਹਨਾਂ ਦੀਆਂ ਫੋਟੋਆਂ ਖਿੱਚਣਾ ਵੀ ਮੈਨੂੰ ਬੜਾ ਚੰਗਾ ਲੱਗਦਾ ਹੈ ਮੇਰੇ ਫੋਨ ਦੇ ਵਿੱਚ ਤੁਸੀਂ ਅਕਸਰ ਦੇਖੋਗੇ ਕਿ ਜਾਂ ਤਾਂ ਸਿਨਰੀਆਂ ਮਤਲਬ ਕਿ ਮੌਸਮ ਦੀਆਂ ਫੋਟੋਆਂ ਆਉਣਗੀਆਂ ਜਾਂ ਮੈਨੂੰ ਕਿਤੇ ਕੋਈ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਦੇ ਆ ਉਹਨਾਂ ਦੀ ਫੋਟੋ ਹੋਣਗੀਆਂ ਜਾਂ ਮੇਰੇ ਦੋਸਤਾਂ ਦੀ ਫੋਟੋਆਂ ਜ਼ਿਆਦਾ ਪਾਈਆਂ ਜਾਂਦੀਆਂ